ਸਤਿ ਸ਼੍ਰੀ ਅਕਾਲ ਜੀ ਤੁਸੀਂ ਭੈਣਾਂ ਦੇ ਢਾਬੇ ਤੋਂ ਬੋਲ ਰਹੇ ਹਾਂ ਮੈਂ ਜੀ ਇੱਕ ਤੁਹਾਨੂੰ ਆਰਡਰ ਲਿਖਾਇਆ ਸੀ ਜੋ ਕਿ ਇੱਕ ਦਾਲ ਮੱਖਣੀ ਸੀ ਇੱਕ ਮਲਾਈ ਕੋਫਤਾ ਸੀ ਅਤੇ ਇੱਕ ਵੈੱਜ਼ ਪਨੀਰ ਸੀ ਚਾਰ ਰੋਟੀਆਂ ਸੀ ਉਹ ਮੈਂ ਆਪਣਾ ਔਰਡਰ ਕੈਂਸਲ ਕਰਾਉਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੇਰਾ ਇਹ ਔਰਡਰ ਕੈਂਸਲ ਕਰ ਦਿੱਤਾ ਜਾਵੇ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਧੰਨਵਾਦ